ਮਾਊਂਟ ਐਵਰੈਸਟ ਦੀ ਚੜ੍ਹਾਈ ਇੱਕ ਚੁਣੌਤੀਪੂਰਨ ਹੈ ਅਤੇ ਮੈਂ ਕਦੇ ਵੀ ਚੜ੍ਹਾਈ ਮਾਊਂਟ ਐਵਰੈਸਟ ਦੀ ਨਹੀਂ ਕੀਤੀ ਮੈਂ ਆਪਣੀ ਡੇਲੀ ਲਾਈਫ ਦੇ ਵਿੱਚ ਐਕਸਸਾਈਜ ਕਰਦਾ ਰਹਿੰਦਾ ਰੱਸਾ ਚੜਦਾ ਰਹਿਦਾਂ ਓਕੇ ਧੰਨਵਾਦ